ਮੇਰਾ ਐਕਸਪੀਰੀਅੰਸ ਹੈ ਮੈਂ ਉੱਤਰਕਾਸ਼ੀ ਗਈ ਗੰਗੋਤਰੀ ਗਈ ਵਾਇਆ ਮੈਂ ਹਰਿਦੁਆਰ ਤੋਂ ਹਰਿਦੁਆਰ ਗਏ ਪਹਿਲਾਂ ਅਸੀਂ ਹਰਿਦੁਆਰ ਤੋਂ ਫਿਰ ਅਸੀਂ ਉੱਥੋਂ ਟੈਕਸੀ ਕੀਤੀ ਦੇਹਰਾਦੂਨ ਤੋਂ ਸ਼ੇਅਰ ਟੈਕਸੀ ਫਿਰ ਉਸ ਤੋਂ ਬਾਅਦ ਅਸੀਂ ਗਏ ਗੰਗੋਤਰੀ ਆਪਣੇ ਉੱਤਰਕਾਸ਼ੀ ਗਏ ਉੱਤਰਕਾਸ਼ੀ ਸਾਡੇ ਗੁਰੂ ਜੀ ਦਾ ਆਸ਼ਰਮ ਸੀਗਾ ਉੱਥੇ ਕਈ ਗਰੀਬ ਲੋਕ ਕਈ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਨਵੀਆਂ ਦੇਖਣ ਨੂੰ ਮਿਲੀਆਂ ਬਹੁਤ ਗਰੀਬ ਦੁਨੀਆਂ ਉੱਥੇ ਰਹਿੰਦੀ ਹੈ ਫਿਰ ਅਸੀਂ ਉੱਥੋਂ ਗਏ ਉ ਗੰਗੋਤਰੀ ਗੰਗੋਤਰੀ ਧਾਮ ਬਹੁਤ ਹੀ ਦੂਰ ਅਤੇ ਚੜਾਈ 'ਤੇ ਹੈ ਉੱਥੇ ਬਹੁਤ ਜ਼ਿਆਦਾ ਸਰਦੀ ਪੈਂਦੀ ਹੈ ਇੰਨੀ ਸਰਦੀ ਪੈਂਦੀ ਹੈ ਕਿ ਟੈਂਪਰੇਚਰ ਪਾਰਾ ਬਹੁਤ ਥੱਲੇ ਚਲੇ ਜਾਂਦਾ ਹੈ ਉੱਥੇ ਅਸੀਂ ਉੱਥੇ ਜਾ ਕੇ ਦੇਖਿਆ ਕਿ ਬਹੁਤ ਗਰੀਬੀ ਹੈ ਲੋਕ ਬਹੁਤ ਜ਼ਿਆਦਾ ਉੱਥੇ ਸਟਰਗਲ ਕਰਦੇ ਆ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਆ ਪਹਾੜੀ ਰਸਤੇ ਬੜੇ ਖਤਰਨਾਕ ਹੁੰਦੇ ਆ ਉੱਥੇ ਸਾਈਡ ਸਾਈਡ 'ਤੇ ਚੱਲ ਕੇ ਉਹਨਾਂ ਦੀਆਂ ਜਾਨਾਂ ਵੀ ਬੜੀ ਮੁਸ਼ਕਿਲਾਂ ਦੇ ਵਿੱਚ ਹੁੰਦੀਆਂ ਨੇ ਪਰ ਇੰਨੀ ਸਰਦੀ ਦੇ ਵਿੱਚ ਉਹ ਬੱਚੇ ਅਸੀਂ ਉੱਥੇ ਦੇਖੇ ਕਿ ਪੈਦਲ ਬੈਗ ਸਿਰ 'ਤੇ ਚੁੱਕ ਕੇ ਇੰਨੀ ਮੁਸ਼ਕਲਾਂ ਨਾਲ ਪੜ੍ਹਨ ਜਾਣਾ ਫਿਰ ਚੜਾਈ ਕਰਨੀ ਉਤਰਾਈ ਕਰਨੀ ਉੱਥੇ ਫਿਰ ਜਾ ਕੇ ਅਸੀਂ ਵੀ ਸੇਵਾ ਕੀਤੀ ਆਸ਼ਰਮ ਦੇ ਵਿੱਚ ਕਿੰਨੇ ਬੰਦਿਆਂ ਦਾ ਮੈਂ ਜਾ ਕੇ ਖਾਣਾ ਬਣਾਇਆ ਫਿਰ ਉਸ ਖਾਣੇ ਨੂੰ ਉਹਨਾਂ ਨੇ ਬੜਾ ਪਸੰਦ ਕੀਤਾ ਉੱਥੋਂ ਉਹਦਾ ਖਾਣਾ ਸਿੰਪਲ ਸੀ ਪੰਜਾਬ ਦਾ ਖਾਣਾ ਬਹੁਤ ਵਧੀਆ ਸੀ ਉਹਨਾਂ ਨੇ ਮੈਨੂੰ ਵੀ ਬਹੁਤ ਪਸੰਦ ਕੀਤਾ ਮੈਨੂੰ ਉੱਥੇ ਉਹਨਾਂ ਨਾਲ ਮਿਲ ਜੁਲ ਕੇ ਉੱਥੇ ਬੱਚਿਆਂ ਦੇ ਨਾਲ ਟਾਈਮ ਬਿਤਾ ਕੇ ਬਹੁਤ ਹੀ ਚੰਗਾ ਲੱਗਿਆ ਉਸ ਬੱਚਿਆਂ ਨੂੰ ਛੋਟੇ ਛੋਟੇ ਭੋਲੇ ਭੋਲੇ ਮੂੰਹ ਦੇਖ ਕੇ ਮੇਰੇ ਦਿਲ 'ਚ ਬਹੁਤ ਹੀ ਜ਼ਿਆਦਾ ਪਿਆਰ ਉਮੜਿਆ ਮੈਂ ਸਾਰੇ ਬੱਚਿਆਂ ਨੂੰ ਲੈ ਕੇ ਉੱਥੇ ਗੰਗਾ ਦੇ ਕੋਲ ਗਈ ਉਹਨਾਂ ਨੂੰ ਬਹੁਤ ਪਿਆਰ ਕੀਤਾ